ਸਤਿ ਸ਼੍ਰੀ ਅਕਾਲ ਜੀ ਪੰਜਾਬੀ ਭਾਸ਼ਾ ਬਾਰੇ ਕੁਛ ਆਮ ਗਲਤ ਧਾਰਨਾਵਾਂ ਵੀ ਬਹੁਤ ਸਾਰੀਆਂ ਬਣੀਆਂ ਹੋਈਆਂ ਹਨ ਜਿਵੇਂ ਕਿ ਲੋਕਾਂ ਨੇ ਬਹੁਤ ਹੀ ਜ਼ਿਆਦਾ ਗਲਤ ਬਣਾਇਆ ਹੈ ਕਿ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਨਸ਼ਾ ਹੁੰਦਾ ਹੈ ਅਤੇ ਜਿਹੜੀ ਵੀ ਕੋਈ ਬਾਹਰੋਂ ਗੱਡੀ ਆਉਂਦੀ ਹੈ ਤਾਂ ਉਸ ਨੂੰ ਉਹ ਹਊਆ ਬਣਾ ਦਿੰਦੇ ਹਨ ਕਿ ਜਿਵੇਂ ਉਸ ਗੱਡੀ ਦੇ ਵਿੱਚ ਕੁਝ ਨਾ ਕੁਝ ਗਲਤ ਹੋਏਗਾ ਪਰ ਹਰ ਵੇਲੇ ਇੱਦਾਂ ਨਹੀਂ ਹੁੰਦਾ ਕੁਝ ਹਰ ਟਾਈਮ ਕੁਝ ਗਲਤ ਵੀ ਨਹੀਂ ਹੁੰਦਾ ਅਤੇ ਕੁਝ ਸਹੀ ਵੀ ਨਹੀਂ ਹੁੰਦਾ ਲੋਕ ਪੰਜਾਬੀ ਭਾਸ਼ਾ ਦੇ ਬਾਰੇ ਗੁਲ ਬਹੁਤ ਹੀ ਜ਼ਿਆਦਾ ਗਲਤ ਗਲਤ ਚੀਜ਼ਾਂ ਵੀ ਬੋਲਦੇ ਹਨ ਕੁਝ ਲੋਕ ਪੰਜਾਬੀ ਭਾਸ਼ਾ ਦੇ ਬਾਰੇ ਬਹੁਤ ਹੀ ਸਾਰੀਆਂ ਗਲਤ ਧਾਰਨਾਵਾਂ ਵੀ ਬਣਾਈਆਂ ਹੋਈਆਂ ਹਨ ਅਤੇ ਇਹਨਾਂ ਨੂੰ ਬਹੁਤ ਗਲਤ ਬੋਲਦੇ ਹਨ ਹੋਰ ਵੀ ਪੰਜਾਬੀ ਭਾਸ਼ਾ ਦੇ ਬਾਰੇ ਬਹੁਤ ਸਾਰੀਆਂ ਧਾਰਨਾਵਾਂ ਬਣਾਈਆਂ ਹੋਣੀਆ ਹੋਈਆਂ ਹਨ ਜਿਵੇਂ ਕਿ ਪੰਜਾਬੀ ਭਾਸ਼ਾ ਦੇ ਵਿੱਚ ਲੋਕ ਅਗਰ ਕੋਈ ਗੱਲ ਕਰਦੇ ਹਨ ਤਾਂ ਲੋਕ ਬਹੁਤ ਹੀ ਜ਼ਿਆਦਾ ਗਲਤ ਮਤਲਬ ਵੀ ਕੱਢਦੇ ਹਨ ਜੋ ਕਿ ਪੰਜਾਬੀ ਭਾਸ਼ਾ ਇੱਦਾਂ ਦੀ ਭਾਸ਼ਾ ਬਿਲਕੁਲ ਵੀ ਨਹੀਂ ਹੈ ਪੰਜਾਬੀ ਭਾਸ਼ਾ ਬਹੁਤ ਹੀ ਵਧੀਆ ਭਾਸ਼ਾ ਹੈ ਅਤੇ ਜੇਕਰ ਇਹਨੂੰ ਸੱਚੀ ਨੀਅਤ ਅਤੇ ਸਾਫ਼ ਲਫਜ਼ ਦੇ ਨਾਲ ਬੋਲਿਆ ਜਾਵੇ ਤਾਂ ਪੰਜਾਬੀ ਭਾਸ਼ਾ ਦੇ ਵਿੱਚ ਬਹੁਤ ਹੀ ਐਸੀਆਂ ਗੱਲਾਂ ਹਨ ਜੋ ਸਾਨੂੰ ਸਿੱਖਣ ਨੂੰ ਮਿਲਦੀਆਂ ਹਨ ਬਾਹਰੋਂ ਵੀ ਬਹੁਤ ਸਾਰੇ ਲੋਕ ਆਉਂਦੇ ਹਨ ਜੋ ਕਿ ਪੰਜਾਬੀ ਭਾਸ਼ਾ ਨੂੰ ਸਿੱਖਦੇ ਹਨ ਉਨ੍ਹਾਂ ਦੀ ਬਹੁਤ ਹੀ ਜ਼ਿਆਦਾ ਦਿਲਚਸਪੀ ਹੁੰਦੀ ਹੈ ਕਿ ਉਹ ਪੰਜਾਬੀ ਭਾਸ਼ਾ ਨੂੰ ਸਿੱਖਣ ਅਤੇ ਆਪਣੇ ਪੰਜਾਬ ਦੇ ਲੋਕਾਂ ਨੇ ਪੰਜਾਬੀ ਭਾਸ਼ਾ ਨੂੰ ਇੱਕ ਹਊਆ ਬਣਾ ਕੇ ਰੱਖਿਆ ਹੋਇਆ ਹੈ ਕਿ ਪੰਜਾਬੀ ਭਾਸ਼ਾ ਦੇ ਵਿੱਚ ਬਹੁਤ ਸਾਰੀਆਂ ਗਲਤ ਧਾਰਨਾਵਾਂ ਵੀ ਕੀਤੀਆਂ ਹੋਈਆਂ ਹਨ ਇਹਨਾਂ ਨੂੰ ਹੱਲ ਕੀਤਾ ਜਾ ਸਕਦਾ ਹੈ ਜੇਕਰ ਅਸੀਂ ਆਪਣੀ ਨੀਅਤ ਸਾਫ਼ ਰੱਖੀਏ ਅਤੇ ਇਸ ਦਾ ਸਹੀ ਇਸਤੇਮਾਲ ਕਰੀਏ ਧੰਨਵਾਦ ਜੀ